ਹੈਲੋ ਸਰ ਟੂਰਿਸਟ ਗਾਈਡ ਬੋਲ ਰਹੇ ਹੋ ਅਤੇ ਅਸੀਂ ਅੰਮ੍ਰਿਤਸਰ ਘੁੰਮਣਾ ਸੀਗਾ ਅਤੇ ਕੱਲ੍ਹ ਮਹਾਰਾਜ ਰਣਜੀਤ ਸਿੰਘ ਫੋਰਮਾ ਉੱਥੇ ਅਸੀਂ ਰੈਜੀਡੈਂਟ ਬਲੂ 'ਚ ਹੈਗੇ ਹਾਂ ਸਵੇਰੇ ਵੇਖ ਲਿਓ ਧੁੱਪ ਦਾ ਕੋਈ ਸੀਨ ਹੋਵੇਗਾ ਅਤੇ ਫਿਰ ਜਲਦੀ ਚਲ ਜਾਂਗੇ ਨਹੀਂ ਹੋਏਗਾ ਅਤੇ ਫਿਰ ਧੁੰਦ ਨਿਕਲਣ ਤੋਂ ਬਾਅਦ ਚਲ ਜਾਂਗੇ ਹਾਂਜੀ ਪੰਜ ਕੁ ਹਜ਼ਾਰ ਰੁਪਏ ਦੀ ਗੱਲ ਹੋਈ ਸੀਗੀ ਹਾਂਜੀ ਹਾਂਜੀ ਦੱਸਤਾ ਭਾਅ ਜੀ ਨੇ ਹਾਂਜੀ ਕਾਰ ਤੁਹਾਡੀ ਅਸੀਂ ਛੇ ਮੈਂਬਰ

ਓਕੇ ਓਕੇ ਓਕੇ